ਹਾਂਜੀ ਸਰ ਕੀ ਤੁਸੀਂ ਕੈਬ ਡਰਾਈਵਰ ਗੱਲ ਕਰ ਰਹੇ ਹੋ ਮੈਂ ਹੁਣੇ ਥੋੜ੍ਹੀ ਦੇਰ ਪਹਿਲਾਂ ਇੱਕ ਬੁਕਿੰਗ ਕਰਵਾਈ ਸੀ ਮਹਿੰਦਰਾ ਕੋਲਜ ਜਾਣ ਦੇ ਲਈ ਤਾਂ ਸਰ ਮੇਰਾ ਜੋ ਪਿਕਅਪ ਪੁਆਇੰਟ ਸੀ ਉਹ ਹੋਟਲ ਸੀ ਜੋ ਕਿ ਦੁਖ ਨਿਵਾਰਨ ਸਾਹਿਬ ਦੇ ਸਾਹਮਣੇ ਹੈ ਉਹ ਪਿਕਅਪ ਪੁਆਇੰਟ ਮੈਂ ਦੱਸਿਆ ਸੀ ਪਰ ਉੱਥੇ ਬਹੁਤ ਜ਼ਿਆਦਾ ਰਸ਼ ਹੋਣ ਦੇ ਕਾਰਣ ਮੈਨੂੰ ਲੱਗਦਾ ਹੈ ਕਿ ਤੁਹਾਡੀ ਟੈਕਸੀ ਜੋ ਹੈ ਕੈਬ ਉਹਦਾ ਉੱਥੇ ਪਹੁੰਚਣਾ ਮੁਸ਼ਕਿਲ ਹੈ ਤਾਂ ਤੁਸੀਂ ਕਿਰਪਾ ਕਰਕੇ ਜੋ ਗੁਰਦੁਆਰਾ ਸਾਹਿਬ ਦੇ ਦੂਸਰੀ ਸਾਈਡ ਖੰਡਾ ਚੌਂਕ ਹੈ ਕਿਉਂਕਿ ਮੈਨੂੰ ਪੈਦਲ ਉੱਥੇ ਜਾਣਾ ਸੌਖਾ ਹੋਵੇਗਾ ਅਤੇ ਉਸ ਤੋਂ ਬਾਅਦ ਅਸੀਂ ਆਰਾਮ ਨਾਲ ਆਪਣੇ ਟਿਕਾਣੇ ਵੱਲ ਮਹਿੰਦਰਾ ਕਾਲਜ ਵੱਲ ਜਾ ਸਕਦੇ ਹਾਂ ਤਾਂ ਕੀ ਕਿਰਪਾ ਕਰਕੇ ਤੁਸੀਂ ਖੰਡਾ ਚੌਂਕ ਦੇ ਕੋਲ ਆ ਸਕਦੇ ਹੋ ਹਾਂਜੀ ਸਰ ਕਿਉਂਕਿ ਖੰਡਾ ਚੌਂਕ ਵੱਲੋਂ ਸਾਨੂੰ ਰੂਟ ਜੋ ਹੈ ਉੱਥੇ ਟਰੈਫਿਕ ਨਹੀਂ ਮਿਲੇਗਾ ਜੋ ਦੁੱਖ ਨਿਵਾਰਨ ਸਾਹਿਬ ਦੇ ਕੋਲ ਲਾਈਟ ਹੈ ਉੱਥੇ ਇਸ ਵੇਲੇ ਬਹੁਤ ਲੰਬਾ ਜਾਮ ਲੱਗਿਆ ਹੋਇਆ ਅਤੇ ਮੈਨੂੰ ਇਹ ਲੱਗਦਾ ਹੈ ਕਿ ਜੇ ਤੁਸੀਂ ਉੱਥੇ ਆਓਗੇ ਤਾਂ ਉੱਥੋਂ ਵਾਪਸ ਜਾਣ ਦੇ ਵਿੱਚ ਹੀ ਸਾਡਾ ਕਾਫ਼ੀ ਸਮਾਂ ਜੋ ਹੈ ਉਹ ਬਰਬਾਦ ਹੋ ਜਾਵੇਗਾ ਤਾਂ ਮੈਂ ਆਰਾਮ ਨਾਲ ਉੱਥੋਂ ਪੈਦਲ ਦੋ ਮਿੰਟ ਦੇ ਵਿੱਚ ਖੰਡਾ ਚੌਕ ਪਹੁੰਚ ਰਿਹਾ ਹਾਂ ਅਤੇ ਤੁਸੀਂ ਕਿਰਪਾ ਕਰਕੇ ਮੈਨੂੰ ਖੰਡਾ ਚੌਂਕ ਤੋਂ ਪਿੱਕ ਕਰ ਲਓ ਅਤੇ ਉਥੋਂ ਅਸੀਂ ਆਪਣੇ ਜੋ ਟਿਕਾਣਾ ਸਾਡਾ ਨੀਯਤ ਕੀਤਾ ਹੋਇਆ ਹੈ ਮਹਿੰਦਰਾ ਕਾਲਜ ਵੱਲ ਤਾਂ ਉੱਥੇ ਅਸੀਂ ਆਰਾਮ ਨਾਲ ਜਾ ਸਕਦੇ ਹਾਂ ਠੀਕ ਹੈ ਜੀ ਮੈਂ ਦੋ ਤਿੰਨ ਮਿੰਟ ਦੇ ਵਿੱਚ ਜੋ ਨਵਾਂ ਦੱਸਿਆ ਟਿਕਾਣਾ ਹੈ ਉੱਥੇ ਪਹੁੰਚਦਾ ਹਾਂ ਧੰਨਵਾਦ ਜੀ ਥੈਂਕ ਯੂ